ਮੈਂ ਕੁਝ ਦਿਨ ਪਹਿਲਾਂ ਹੀ ਪ੍ਰਸਿੱਧ ਪ੍ਰੋਡਕਟ ਕੰਪਨੀ ਮਾਮਾਅਰਥ ਤੋਂ ਫੇਸ਼ੀਅਲ ਕਿੱਟ ਦਾ ਔਡਰ ਕੀਤਾ ਸੀ ਅਤੇ ਉਹ ਔਡਰ ਮੈਨੂੰ ਥੋੜ੍ਹੇ ਹੀ ਸਮੇਂ 'ਚ ਡਿਲੀਵਰ ਹੋ ਗਿਆ ਸੀ ਮੈਂ ਇਸ ਰਾਹੀਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂ ਪ੍ਰੋਡਕਟ ਬਹੁਤ ਹੀ ਵਧੀਆ ਸੀ ਸਭ ਸਭ ਤੋਂ ਵੱਡੀ ਗੱਲ ਪ੍ਰੋਡਕਟ ਦੀ ਕੋਈ ਵੀ ਨੁਕਸਾਨਦਾਇਕ ਜੋ ਵਿਧੀ ਹੈ ਉਹ ਨਹੀਂ ਸੀ ਅਤੇ ਪ੍ਰੋਡਕਟ ਦਾ ਰੇਟ ਉਹਦੀ ਸ਼ਮਤਾ ਅਨੁਸਾਰ ਬਹੁਤ ਹੀ ਜਾਇਜ਼ ਸੀ ਪ੍ਰੋਡਕਟ ਵਿੱਚ ਕੋਈ ਵੀ ਬਾਹਰੀ ਕੈਮੀਕਲ ਦਾ ਕਾ ਕੈਮੀਕਲ ਸ਼ਾਮਿਲ ਨਹੀਂ ਸੀ ਜਿਸ ਕਰਕੇ ਉਹ ਹਰ ਸਕਿਨ ਟਾਇਪ ਨੂੰ ਟਾਇਪ ਨੂੰ ਸੂਟੇਬਲ ਸੀ ਕੋਈ ਵੀ ਉਸਦਾ ਵਰਤੋਂ ਕਰ ਸਕਦਾ ਸੀ ਮੈਂ ਉਸ ਪ੍ਰੋਡਕਟ ਦੀ ਵਰਤੋਂ ਇੱਕ ਹਫਤੇ ਤੋਂ ਕਰ ਰਹੀ ਹਾਂ ਅਤੇ ਮੈਨੂੰ ਉਸਦੇ ਬਹੁਤ ਵਧੀਆ ਰਿਜ਼ਲਟਸ ਮਿਲ ਮਿਲੇ ਹਨ ਮੈਂ ਦੇਖਿਆ ਹੈ ਕਿ ਉਹ ਪ੍ਰੋਡਕਟ ਦੀ ਵਰਤੋਂ ਦੇ ਨਾਲ ਮੇਰੀ ਸਕਿਨ ਵਿੱਚ ਕਾਫੀ ਬਦਲਾਵ ਆਏ ਹਨ ਮੇਰੀ ਸਕਿਨ ਕਾਫੀ ਗਲੋਇੰਗ ਅਤੇ ਤਾਜ਼ਾ ਰਹਿਣ ਲੱਗ ਗਈ ਹੈ